ਪੰਜਾਬ ਦਾ ਇਤਿਹਾਸ ਨਾਲ ਬਹੁਤ ਹੀ ਗਹਿਰਾ ਸੰਬੰਧ ਹੈ ਜਿਸ ਕਾਰਨ ਪੰਜਾਬ ਵਿੱਚ ਬਹੁਤ ਸਾਰੇ ਇਤਿਹਾਸਿਕ ਸਮਾਗਮ ਵੀ ਹਨ ਜਿਵੇਂ ਗੋਲਡਨ ਟੈਂਪਲ ਜਲਿਆਂਵਾਲਾ ਬਾਗ ਵਾਹਗਾ ਬਾਰਡਰ ਗੁਰੂ ਕੇ ਮਹਿਲ ਮਹਾਰਾਜਾ ਰਣਜੀਤ ਸਿੰਘ ਵੌਰ ਮੈਮੋਰੀਅਲ ਅਤੇ ਹੋਰ ਵੀ ਬਹੁਤ ਸਾਰੇ ਇਹ ਸਭ ਇਸ ਕਾਰਨ ਪ੍ਰਸਿੱਧ ਹਨ ਕਿਉਂਕਿ ਇਹਨਾਂ ਦਾ ਇਤਿਹਾਸ ਨਾਲ ਕੁਛ ਨਾ ਕੁਛ ਸੰਬੰਧ ਜੁੜਿਆ ਹੋਇਆ ਹੈ ਅਤੇ ਸ਼ਰਧਾਲੂ ਇਥੇ ਮੱਥਾ ਟੇਕਣ ਆਉਂਦੇ ਹਨ ਕੋਈ ਨਾ ਕੋਈ ਦਿਨ ਤਿਉਹਾਰ 'ਤੇ ਅਤੇ ਨਾਲ ਹੀ ਵੈਸੇ ਵੀ ਟੂਰਿਸਟ ਬੇਸ 'ਤੇ ਆਉਂਦੇ ਹਨ ਜੇ ਗੱਲ ਕੀਤੀ ਜਾਵੇ ਗੋਲਡਨ ਟੈਂਪਲ ਦੀ ਤਾਂ ਇਹ ਹਰ ਇਹਨੂੰ ਹਰਿਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ ਇਹ ਅੰਮ੍ਰਿਤਸਰ ਵਿੱਚ ਸਥਿਤ ਹੈ ਇਸ ਨੂੰ ਸਵੈ ਸਵਰਨ ਮੰਦਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇੱਥੇ ਬਹੁਤ ਸਾਰੇ ਪਰ ਪਰਯਟਕ ਅਤੇ ਸ਼ਰਧਾਲੂ ਵੀ ਆਉਂਦੇ ਹਨ ਇਸ ਮੰਦਿਰ ਦਾ ਨਿਰਮਾਣ ਸੋਲ੍ਹਵੀਂ ਸ਼ਤਾਬਦੀ ਵਿੱਚ ਹੋਇਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੀ ਨੀਂਹ ਵੀ ਸੋਲ੍ਹਵੀਂ ਸ਼ਤਾਬਦੀ ਵਿੱਚ ਹੀ ਰੱਖੀ ਸੀ ਵਿਸਾਖੀ ਵਾਲੇ ਦਿਨ ਅਤੇ ਇਹਦੇ ਆਸ ਪਾਸ ਇੱਕ ਬਹੁਤ ਹੀ ਸੁੰਦਰ ਝੀਲ ਹੈ ਨਾਲ ਇਹ ਪੂਰੇ ਸ਼ੁੱਧ ਸੋਨੇ ਦਾ ਬਣਿਆ ਹੋਇਆ ਹੈ ਇਸ ਮੰਦਿਰ ਦੀ ਯਾਤਰਾ ਕਰਨ ਦਾ ਸਭ ਤੋਂ ਵਧੀਆ ਸਮੇਂ ਸਰਦੀਓਂ ਦੇ ਦੌਰਾਨ ਹੁੰਦਾ ਹੈ ਕਿਉਂਕਿ ਉਸ ਟਾਈਮ 'ਤੇ ਪੂਰਾ ਹਰਿਮੰਦਰ ਸਾਹਿਬ ਜਗਮਗ ਜਗਮਗ ਖਿਲਦਾ ਹੈ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਵੀ ਹੈ ਜਿਸ ਵਿੱਚ ਜਨਰਲ ਡਾਇਰ ਨੇ ਬਹੁਤ ਸਾਰੇ ਲੋਕਾਂ ਨੂੰ ਬੇਕਸੂਰਾਂ ਨੂੰ ਗੋਲੀਆਂ ਨਾਲ ਮਾਰਿਆ ਸੀ ਅਤੇ ਜੇ ਗੱਲ ਕਰੀਏ ਰਣਜੀਤ ਸਿੰਘ ਮਿਊਜ਼ੀਅਮ ਦੀ ਉਹ ਵੀ ਅੰਮ੍ਰਿਤਸਰ ਵਿੱਚ ਰਾਮਬਾਗ ਗਾਰਡਨ ਵਿੱਚ ਹੀ ਸਥਿਤ ਹੈ ਇਹ ਅਠਾਰਵੀਂ ਅਤੇ ਉੱਨੀਵੀਂ ਸ਼ਤਾਬਦੀ ਦੇ ਵਿੱਚ ਸਮੁਦਾਇ ਦੀ ਕਲਾ ਵਾਸਤੂ ਕਲਾ ਅਤੇ ਇਤਿਹਾਸ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਦਿੰਦਾ ਹੈ ਮਹਿਲ ਨੂੰ ਨੀਈਟੀਨ ਸੈਵਨਟੀ ਸੈਵਨ ਵਿੱਚ ਇੱਕ ਮਿਊਜ਼ੀਅਮ ਵਿੱਚ ਪਰਿਵਰਤਿਤ ਕਰ ਦਿੱਤਾ ਗਿਆ ਸੀ ਅਤੇ ਇਹ ਸਵਰਨ ਮੰਦਿਰ ਜੋ ਗੋਲਡਨ ਟੈਂਪਲ ਹੈ ਉਹਦੇ ਕੋਲ ਇੱਕ ਸਥਾ ਇੱਕ ਚਾਰ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਵੀ ਹੈ ਇਹ ਹੀ ਕਾਰਨ ਹੈ ਕਿ ਪੰਜਾਬ ਵਿੱਚ ਕੁਛ ਇਤਿਹਾਸਿਕ ਸਮਾਗਮ ਹਨ ਅਤੇ ਇਤਿਹਾਸ ਨਾਲ ਜੁੜਿਆ ਹੈ ਪੰਜਾਬ